ਭੰਗੜਾ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਕਦਮਾਂ ਵਾਲਾ ਇੱਕ ਸ਼ਕਤੀਸ਼ਾਲੀ ਅਤੇ ਸ਼ਾਨਦਾਰ ਨਾਚ ਹੈ ਇੱਥੇ ਕੁਝ ਪ੍ਰਮੁੱਖ ਭੰਗੜਾ ਡਾਂਸ ਸਟੈਪਸ ਇੱਕ ਸੰਖੇਪ ਜਾਣਕਾਰੀ ਹੈ ਅਤੇ ਇਹ ਕਿਵੇਂ ਉਹਨਾਂ ਨੂੰ ਸੱਭਿਆਚਾਰਕ ਮਹੱਤਵ ਨੂੰ ਦਰਸਾਉਂਦੇ ਹਨ ਝੂਮਰ ਇਸ ਪੜਾਅ ਵਿੱਚ ਸਿਰ ਅਤੇ ਮੋਢਿਆਂ ਦੀ ਇੱਕ ਤਾਲ ਵੱਧ ਇੱਕ ਦੂਜੇ ਦੇ ਪਾਸੇ ਦੀ ਗਤੀ ਨੂੰ ਸ਼ਾਮਲ ਹੁੰਦੀ ਹੈ ਅਕਸਰ ਹੱਥਾਂ ਦੀ ਤਾੜੀ ਦੇ ਨਾਲ ਇਹ ਇੱਕ ਸ਼ਾਨਦਾਰ ਅੰਦੋਲਨ ਹੈ ਜੋ ਡਾਂਸ ਵਿੱਚ ਸ਼ਾਨਦਾਰ ਜੋੜਦਾ ਹੈ ਅਤੇ ਆਮ ਤੌਰ 'ਤੇ ਭੰਗੜੇ ਦੇ ਹੌਲੀ ਵਧੇਰੇ ਤਾਲ ਵਾਲੇ ਹਿੱਸਿਆਂ ਵਿੱਚ ਪੇਸ਼ ਕੀਤਾ ਜਾਂਦਾ ਹੈ ਚੱਕਰ ਇਸ ਪੜਾਅ ਵਿੱਚ ਇੱਕ ਚੱਕਰ ਵਿੱਚ ਘੁੰਮਣਾ ਸ਼ਾਮਲ ਹੈ ਇਹ ਅਕਸਰ ਊਚ ਊਰਜਾ ਨਾਲ ਕੀਤਾ ਜਾਂਦਾ ਹੈ ਅਤੇ ਹੱਥਾਂ ਦੀਆਂ ਹਰਕਤਾਂ ਦੇ ਨਾਲ ਹੋ ਸਕਦਾ ਹੈ ਜੋ ਮੱਖਣ ਨੂੰ ਰਿੜਕਣ ਦੀ ਕਿਰਿਆ ਦੀ ਨਕਲ ਕਰਦਾ ਹੈ ਢੋਲ ਭੰਗੜਾ ਸੰਗੀਤ ਵਿੱਚ ਵਰਤੇ ਜਾਣ ਵਾਲੇ ਪਰੰਪਰਾਗਤ ਢੋਲ ਦੇ ਨਾਮ 'ਤੇ ਨਾਮ ਦਿੱਤਾ ਗਿਆ ਹੈ ਇਸ ਪੜਾਅ ਵਿੱਚ ਤਾਲ ਵੱਧ ਸਟੰਪਿਕ ਜਾਂ ਢੋਲ ਦੀਆਂ ਹਰਕਤਾਂ ਸ਼ਾਮਲ ਹਨ ਨੱਚਣ ਵਾਲੇ ਅਕਸਰ ਆਪਣੇ ਪੈਰਾਂ ਦੇ ਹੱਥਾਂ ਨਾਲ ਢੋਲ ਦੀ ਬੀਟ ਦੀ ਨਕਲ ਕਰਦੇ ਹਨ ਡਾਂਸ ਅਤੇ ਸੰਗੀਤ ਦੇ ਵਿਚਕਾਰ ਸੰਬੰਧ 'ਤੇ ਜ਼ੋਰ ਦਿੰਦੇ ਹਨ ਪੰਜਾਬੀ ਸੱਭਿਆਚਾਰ ਵਿੱਚ ਡਾਂਸ ਸਟੈਪਸ ਦੀ ਭੂਮਿਕਾ ਜਸ਼ਨ ਅਤੇ ਖੁਸ਼ੀ ਭੰਗੜੇ ਦੀਆਂ ਪੌੜੀਆਂ ਦਾ ਊਰਜਾਵਾਨ ਅਤੇ ਤਾਲ ਵਾਲਾ ਸੁਭਾਅ ਪੰਜਾਬੀ ਸੱਭਿਆਚਾਰ ਦੀ ਜਸ਼ਨ ਭਾਵਨਾ ਨੂੰ ਦਰਸਾਉਂਦਾ ਹੈ ਭਾਈਚਾਰਾ ਅਤੇ ਏਕਤਾ ਭੰਗੜੇ ਦੇ ਬਹੁਤ ਸਾਰੇ ਕਦਮਾਂ ਵਿੱਚ ਸਮੂਹਿਕ ਤਾਲਮੇਲ ਅਤੇ ਆਪਸੀ ਤਾਲਮੇਲ ਸ਼ਾਮਲ ਹੁੰਦਾ ਹੈ ਜੋ ਡਾਂਸ ਦੇ ਫਿਰਕੂ ਪਹਿਲੂ ਨੂੰ ਉਜਾਗਰ ਕਰਦਾ ਹੈ ਸੱਭਿਆਚਾਰ ਪ੍ਰਗਟਾਵਾ ਭੰਗੜਾ ਡਾਂਸ ਸਟੈਪ ਅਕਸਰ ਰਵਾਇਤੀ ਖੇਤੀਬਾੜੀ ਅਭਿਆਸਾਂ ਤਿਉਹਾਰਾਂ ਦੀ ਗਤੀਵਿਧੀ ਅਤੇ ਸੱਭਿਆਚਾਰਕ ਰੀਤੀ ਰਿਵਾਜ਼ਾਂ ਨੂੰ ਦਰਸਾਉਂਦਾ ਹੈ ਉਦਾਹਰਣ ਲਈ ਫੂਮਾ ਕਦਮ ਜੋ ਮੰਥਨ ਦੀ ਨਕਲ ਕਰਦਾ ਹੈ ਖੇਤੀਬਾੜੀ ਗਤੀਵਿਧੀਆਂ ਨਾਲ ਸੰਬੰਧਿਤ ਹੈ ਅਤੇ ਜਦੋਂ ਝੂਮਰ ਵਾਢੀ ਅਤੇ ਤਿਉਹਾਰਾਂ ਦੇ ਤਾਲ ਵੱਧ ਜਸ਼ਨ ਨੂੰ ਦਰਸਾਉਂਦਾ ਹੈ ਧਾਰਮਿਕ ਅਤੇ ਸਮਾਜਿਕ ਮਹੱਤਤਾ ਧਾਰਮਿਕ ਅਤੇ ਸਮਾਜਿਕ ਸੰਦਰਭਾਂ ਨੂੰ ਵਿੱਚ ਭੰਗੜਾ ਸ਼ਰਧਾ ਸ਼ੁਕਰ ਗੁਜ਼ਾਰੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਦੇ ਇੱਕ ਸਾਧਨ ਵਜੋਂ ਕੰਮ ਕਰਦਾ ਹੈ ਸੰਖੇਪ ਵਿੱਚ ਭੰਗੜੇ ਦੇ ਨੱਚਣ ਵਾਲੇ ਕਦਮ ਸਿਰਫ਼ ਅੰਦੋਲਨ ਹੀ ਨਹੀਂ ਸਗੋਂ ਪੰਜਾਬੀ ਜੀਵਨ ਦੇ ਸੱਭਿਆਚਾਰਕ ਸਮਾਜਿਕ ਅਤੇ ਧਾਰਮਿਕ ਤਾਣੇ ਬਾਣੇ ਵਿੱਚ ਡੂੰਘੇ ਰੂਪ ਵਿੱਚ ਸ਼ਾਮਲ ਹਨ